ਛੱਬੀ ਜੁਲਾਈ ਉੱਨੀ ਸੌੌ ਚੁਰਾਨਵੇਂ ਤਿੰਨ ਦਸੰਬਰ ਉੱਨੀ ਸੌ ਉਣਹੱਤਰ ਅੱਠ ਜੂਨ ਉੱਨੀ ਸੌ ਛਿਆਨਵੇਂ ਅੱਠ ਜੂਨ ਉੱਨੀ ਸੌ ਚੁਰਾਸੀ ਪੰਜ ਅਗਸਤ ਉੱਨੀ ਸੌ ਛਿਆਨਵੇਂ